ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਹੋਰ ਜੌਬ ਕਿੱਦਾਂ ਚੱਲ ਰਹੀ ਤੁਹਾਡੀ ਬਸ ਵਧੀਆ ਵਧੀਆ ਹੋਰ ਸੁਣਾਓ ਤੁਸੀਂ ਕੀ ਕੀ ਚੱਲ ਰਿਹਾ ਅੱਜ ਕੱਲ੍ਹ ਕੀ ਕਰ ਰਹੇ ਤੁਹਾਡੇ ਭਤੀਜੇ ਭਤੀਜੀਆਂ ਓਕੇ ਅੱਛਾ ਜੀ

ਓਕੇ ਓਕੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਤਾਂ ਹੈ ਹੀ ਹੈ ਸਹੀ ਗੱਲ ਹੈ ਮੈਮ ਮੈਮ ਇੱਕ ਤਾਂ ਤੁਸੀਂ ਥੋੜ੍ਹਾ ਬੱਚੇ ਦਾ ਇੰਨਟਰਸਟ ਦੇਖਿਓ ਹੈ ਨਾ ਵੀ ਇੰਨਟਰਸਟ ਕਿਹੜੇ ਸਬਜੈਕਟ 'ਚ ਉਹਦਾ ਹੈਗਾ ਆ ਪਹਿਲਾਂ ਤਾਂ ਚੀਜ਼ ਇਹ ਪਤਾ ਕਰਨੀ ਬਹੁਤ ਜ਼ਰੂਰੀ ਹੈ ਵੀ ਉਹਦਾ ਕੀ ਹੈਗਾ ਇੰਟਰਸਟ ਕੀ ਹੈ ਅਤੇ ਦੂਜਾ ਆਪਾਂ ਸਕੌਪ ਦੇਖਣਾ ਕਿ ਬੱਚੇ ਨੇ ਆ ਇਸ ਤੋਂ ਬਾਅਦ ਸਟੱਡੀ ਕੰਪਲੀਸ਼ਨ ਤੋਂ ਬਾਅਦ ਉਹਨਾਂ ਨੇ ਜੌਬ ਵਗੈਰਾ ਲੱਭਣੀ ਹੈ ਸੋ ਉਹਦੇ ਚਾਨਸ ਆਪਾਂ ਦੇਖਾਂਗੇ ਕਿਸਦੇ ਵਿੱਚ ਜ਼ਿਆਦਾ ਹੈਗੇ ਆ ਹੈ ਨਾ ਜਦੋਂ ਮੇਰੇ ਹੁਣ ਬੱਚੇ ਬੇਟੇ ਨੇ ਉਹਨੇ ਬੀ ਸੀ ਏ ਕੀਤਾ ਆ ਕਿਉਂਕਿ ਜਿਵੇਂ ਕੰਪਿਊਟਰ ਜਾਂ ਆਈ ਟੀ ਦੇ ਵਿੱਚ ਜ਼ਿਆਦਾ ਹੈਗੇ ਚਾਂਨਸਸ ਹੈ ਨਾ ਵਰਲਡ ਚਾਹੇ ਇੰਡੀਆ ਵਿੱਚ ਆ ਜਾਂ ਫੌਰਨ ਜਾਣਾ ਤਾਂ ਉੱਥੇ ਵੀ ਇਹਦੇ ਜ਼ਿਆਦਾ ਬ੍ਰਾਈਟ ਚਾਂਨਸਸ ਹੈਗੇ ਆ ਸੋ ਇੱਦਾਂ ਦਾ ਦੇਖ ਲਓ ਜੇ ਉਹਦਾ ਇੰਨਟਰਸਟ ਹੈਗਾ ਹੈ ਇਸ 'ਚ ਇਸ ਸਟ੍ਰੀਮ ਦੇ ਵਿੱਚ ਉਸਦਾ ਠੀਕ ਗੁੱਡ ਹਾਂਜ ਹਾਂਜੀ ਹਾਂਜੀ ਹਾਂਜੀ ਹੁਣ ਬੇਟੇ ਨੇ ਇੱਥੇ ਵੀ ਇਹ ਹੀ ਕੀਤਾ ਸੀਗਾ ਬੀ ਸੀ ਏ ਹੁਣ ਬਾਹਰ ਵੀ ਉਹ ਆਈ ਟੀ ਨਾਲ ਰਿਲੇਟਿਡ ਹੀ ਕਰ ਰਿਹਾ ਇਹਦਾ ਹੀ ਉਹ ਕਹਿ ਰਿਹਾ ਸੀ ਕਹਿੰਦਾ ਮੰਮੀ ਉੱਥੇ ਬਹੁਤ ਅੱਛੇ ਚਾਂਨਸ ਹੈਗੇ ਆ ਬ੍ਰਾਈਟ ਚਾਂਨਸਸ ਹੈਗੇ ਆ ਇੱਥੇ ਮਤਲਬ ਕੰਪਿਊਟਰ ਜੌਬ ਜ਼ਿਆਦਾ ਹੈ ਤੁਹਾਨੂੰ ਪਤਾ ਅੱਜ ਕੱਲ੍ਹ ਹਰ ਇੱਕ ਫੀਲਡ ਦੇ ਵਿੱਚ ਕੰਪਿਊਟਰ ਯੂਸ ਹੁੰਦਾ ਆ ਹਰ ਇੱਕ ਹੈ ਨਾ ਅਤੇ ਹਰ ਇੱਕ ਆਫ਼ਿਸ ਦੇ ਵਿੱਚ ਰੈਸਟੋਰੈਂਟਾਂ ਵਿੱਚ ਜਿੱਥੇ ਵੀ ਬੱਚੇ ਨੇ ਜੌਬ ਕਰਨੀ ਹੈ ਤਾਂ ਕੰਪਿਊਟਰ 'ਤੇ ਜ਼ਿਆਦਾ ਲੋੜ ਪੈਂਦੀ ਹੈ ਸੋ ਮੈਂ ਤਾਂ ਤੁਹਾਨੂੰ ਇਹ ਹੀ ਸੁਜੈਸਟ ਕਰੂੰਗੀ ਜੇ ਤੁਸੀਂ ਇਹਨੂੰ ਇਹਦੇ ਕੰਪਿਊਟਰ ਸਟ੍ਰੀਮ ਦੇ ਵਿੱਚ ਹੀ ਕੁਛ ਕਰਵਾ ਦਿਉ ਤਾਂ ਬੈਟਰ ਹੈ ਹੈ ਨਾ ਉਹਦਾ ਇੰਟਰਸਟ ਵੀ ਹੋਵੇਗਾ ਤਾਂ ਅੱਛੀ ਗੱਲ ਹੈ ਜੇ ਇਹਨੂੰ ਐਡੀਸ਼ਨਲ ਰੱਖਿਆ ਇੱਟ ਮੀਨਜ਼ ਉਹਦਾ ਇੰ ਇੰਨਟਰਸਟ ਵੀ ਹੈਗਾ ਆ ਉਹ ਕਰ ਲਓ ਦੇਖ ਲਓ ਹੈ ਨਾ ਓਕੇ ਓਕੇ ਮੈਮ ਹਾਂਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ